ਮੇਰਾ ਨਾਮ ਮਮਤਾ ਦੇਵੀ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਕੁਝ ਦਿਨ ਪਹਿਲਾਂ ਮੈਂ ਤੁਹਾਡੀ ਐਪ ਰਾਹੀਂ ਇੱਕ ਔਡਰ ਕੀਤਾ ਸੀ ਮੇਰਾ ਔਡਰ ਆਈਡੀ ਨੰਬਰ ਹੈ ਚਾਰ ਛੇ ਦੋ ਤਿੰਨ ਜਿਸ ਦਾ ਭੁਗਤਾਨ ਔਨਲਾਈਨ ਅਕਾਊਂਟ ਰਾਹੀਂ ਕਰ ਦਿੱਤਾ ਸੀ ਕੁਝ ਦਿਨ ਬਾਅਦ ਮੈਂ ਉਸ ਔਡਰ ਨੂੰ ਰੱਦ ਕਰਨ ਦੀ ਮੰਗ ਪਾਈ ਕੁਝ ਕਾਰਨਾਂ ਦੇ ਕਾਰਨ ਅਤੇ ਮੈਂ ਕਿਹਾ ਸੀ ਕਿ ਮੇਰੇ ਪੈਸੇ ਜਲਦ ਤੋਂ ਜਲਦ ਮੇਰੇ ਅਕਾਊਂਟ ਵਿੱਚ ਵਾਪਸ ਕਰ ਦਿੱਤੇ ਜਾਣ ਤੁਹਾਡੀ ਕੰਪਨੀ ਰਾਹੀਂ ਮੈਨੂੰ ਬੋਲਿਆ ਗਿਆ ਸੀ ਕਿ ਇਹ ਕੁਝ ਦਿਨਾਂ ਅੰਦਰ ਹੀ ਤੁਹਾਡੇ ਪੈਸੇ ਟ੍ਰਾਂਸਫਰ ਕੀਤੇ ਜਾਣਗੇ ਪਰ ਅੱਜ ਇੱਕ ਹਫਤਾ ਹੋ ਚੁੱਕਿਆ ਹੈ ਅਤੇ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕਿ ਮੇਰੇ ਪੈਸੇ ਅਜੇ ਵੀ ਮੇਰੀ ਅਕਾਊਂਟ ਵਿੱਚ ਵਾਪਸ ਨਹੀਂ ਆਏ ਅਤੇ ਤੁਹਾਡੇ ਨਾਲ ਇਹ ਬੇਨਤੀ ਹੈ ਕਿ ਮੇਰੇ ਪੈਸੇ ਮੇਰੇ ਅਕਾਊਂਟ ਵਿੱਚ ਵਾਪਸ ਕੀਤੇ ਜਾਣ ਇੱਕ ਵਾਰੀ ਮੇਰਾ ਔਡਰ ਆਈਡੀ ਨੰਬਰ ਫਿਰ ਤੋਂ ਨੋਟ ਕਰ ਲਿਆ ਜਾਵੇ ਚਾਰ ਛੇ ਨੌ ਅੱਠ ਇਸ ਦੀ ਕੀਮਤ ਸਿਰਫ ਪੰਜ ਹਜ਼ਾਰ ਰੁਪਏ ਹੈ ਜੋ ਕਿ ਅਪ ਜੋ ਕਿ ਮੈਂ ਆਪਣੇ ਔਨਲਾਈਨ ਖਾਤੇ ਰਾਹੀਂ ਐਪ ਐਪ ਰਾਹੀਂ ਤੁਹਾਡੇ ਅਕਾਊਂਟ ਵਿੱਚ ਭੇਜ ਦਿੱਤੀ ਸੀ ਅਤੇ ਮੈਂ ਕੁਝ ਕਾਰਨਾਂ ਦੇ ਕਾਰਨ ਔਡਰ ਰੱਦ ਕਰ ਦਿੱਤਾ ਕਿਉਂਕਿ ਮੈਂ ਆਪਣੇ ਐਡਰੈਸ 'ਤੇ ਮੌਜੂਦ ਨਹੀਂ ਸੀ ਕਿਉਂਕਿ ਉਸ ਸਮੇਂ ਸਾਨੂੰ ਕਿਤੇ ਜਾਣਾ ਪਿਆ ਸੀ ਉਸ ਔਡਰ ਰੱਦ ਕਰ ਦਿੱਤਾ ਅਤੇ ਕਿਹਾ ਸੀ ਕਿ ਮੇਰੇ ਬਣਦੇ ਪੈਸੇ ਮੈਨੂੰ ਮੇਰੇ ਅਕਾਊਂਟ ਵਿੱਚ ਪਾ ਦਿੱਤੇ ਜਾਣਗੇ ਪਰ ਮੈਨੂੰ ਇਹ ਜਾਣ ਕੇ ਬੁਰਾ ਲੱਗਿਆ ਕਿ ਮੇਰੇ ਬਣਦੇ ਪੈਸੇ ਮੇਰੇ ਅਕਾਊਂਟ ਵਿੱਚ ਵਾਪਸ ਨਹੀਂ ਆਏ